ਹੈਲੋ ਠੀਕ ਹੈ ਜੀ ਵਧੀਆ ਤੁਸੀਂ ਦੱਸੋ ਹਾਂਜੀ ਠੀਕ ਠਾਕ ਆ ਵਧੀਆ ਕੀ ਕਰਦੇ ਸੀ ਅੱਛਾ ਕੰਮ ਕਾਰ ਕਰ ਲਿਆ ਕੀ ਕੀ ਕੀ ਆ ਮੈਨੂੰ ਨਹੀਂ ਪਤਾ ਹਾਂਜੀ ਆਪਾਂ ਨੇ ਜਾਣਾ ਹੈ ਕੱਲ੍ਹ ਨੂੰ ਡਿਨਰ ਕਰਨ ਨੂੰ ਰਾਜੇ ਢਾਬੇ ਜਾਂ ਪੰਜਾਬੀ ਢਾਬੇ ਚੱਲਾਂਗੇ ਨਹੀਂ ਮੈਨੂੰ ਨਹੀਂ ਪਤਾ ਤੁਸੀਂ ਦੱਸ ਦਿਉ ਓ ਮੈਂ ਤਾਂ ਭੁੱਲ ਹੀ ਗਿਆ ਸੀ ਹਾਂਜੀ ਹਾਂ ਅੱਗੇ ਕੀ ਕਰਨਾ ਫਿਰ ਠੀਕ ਆ ਹਾਂ ਆਪਾਂ ਨਾ ਇਕੱਠੇ ਹੋ ਕੇ ਸਲਾਹ ਕਰਕੇ ਥੋੜ੍ਹੇ ਰਿਸ਼ਤੇਦਾਰ ਬੁਲਾ ਕੇ ਜਨਮਦਿਨ ਮਨਾ ਲਾਂਗੇ ਪਾਠ ਕਰਾ ਦਾਂਗੇ ਹੋਰ ਆਪਾਂ ਦੇਖਦੇ ਹਾਂ ਖਾਣ ਪੀਣ ਬਾਰੇ ਕਿ ਕੀ ਬਣਾਉਣਾ ਉਸ ਦਿਨ ਦੇਖ ਲਾਂਗੇ ਕੀ ਕਰਨਾ ਚਲੋ ਠੀਕ ਹੈ ਜੀ ਘਰ ਆ ਕੇ ਗੱਲ ਕਰਦੇ ਫਿਰ